ਹਾਂਜੀ ਮੇਰੇ ਕੋਲ ਕਾਫੀ ਜ਼ਿਆਦਾ ਕਿੱਸੇ ਹਨ ਜੋ ਕਿ ਬਹੁਤ ਹੀ ਚੁਣੌਤੀਪੂਰਨ ਅਤੇ ਮਨੋਰੰਜਕ ਵੀ ਰਹਿ ਰਹਿ ਚੁੱਕੇ ਹਨ ਮੈਂ ਜਿਸ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਕਰਨ ਜਾ ਰਿਹਾ ਹਾਂ ਪਹਿਲਾਂ ਤਾਂ ਮੈਂ ਆਹ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਸਾਈਕਲਿੰਗ ਦਾ ਬਹੁਤ ਸ਼ੌਕ ਸੀ ਮੈਂ ਬਹੁਤ ਛੋਟੇ ਹੁੰਦੇ ਬਹੁਤ ਹੀ ਜ਼ਿਆਦਾ ਸਾਈਕਲ ਚਲਾਉਂਦਾ ਸੀਗਾ ਮੈਂ ਸਾਈਕਲ 'ਤੇ ਇੱਧਰ ਉੱਧਰ ਨਿਕਲ ਜਾਂਦਾ ਸੀ ਅਤੇ ਸਾਈਕਲ ਚਲਾਉਣ ਨਾਲ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ ਅਤੇ ਮਨ ਮਨਮੋਹਕ ਭਰਿਆ ਹੋ ਜਾਂਦਾ ਸੀ ਹੁਣ ਮੈਂ ਛੋਟੇ ਹੁੰਦੇ ਦਾ ਆਪਣਾ ਇੱਕ ਕਿੱਸਾ ਸੁਣਾਉਣ ਜਾ ਰਿਹਾ ਹਾਂ ਜੋ ਕਿ ਬਹੁਤ ਹੀ ਚੁਣੌਤੀਪੂਰਨ ਸੀਗਾ ਮੈਂ ਸਾਈਕਲ 'ਤੇ ਜਾ ਰਿਹਾ ਸੀ ਮੈਂ ਜਾਂਦੇ ਜਾਂਦੇ ਕਾਫੀ ਦੂਰ ਨਿਕਲ ਗਿਆ ਮੈਨੂੰ ਰਸਤੇ ਦਾ ਪਤਾ ਨਹੀਂ ਲੱਗਾ ਅੱਗੇ ਜਾ ਕੇ ਮੈਂ ਰਸਤੇ ਆ ਰਸਤਾ ਖੋ ਗਿਆ ਫਿਰ ਮੈਨੂੰ ਬਹੁਤ ਹੀ ਘਬਰਾਹਟ ਹੋਣੀ ਸ਼ੁਰੂ ਹੋਈ ਪਰ ਮੇਰੇ ਮਨ 'ਚ ਹੌਸਲਾ ਸੀ ਅਤੇ ਮੈਂ ਸਾਈਕਲ ਚਲਾਈ ਜਾ ਰਿਹਾ ਸੀ ਮੈਂ ਕਿਹਾ ਕਿਤੇ ਨਾ ਕਿਤੇ ਨਿਕਲ ਜਾਵਾਂਗੇ ਆਪਾਂ ਫਿਰ ਅਚਾਨਕ ਕਿ ਕੀ ਹੋਇਆ ਅਚਾਨਕ ਹੀ ਮੇਰੇ ਮਗਰ ਕੁੱਤੇ ਪੈ ਗਏ ਦੋ ਚਾਰ ਕੁੱਤੇ ਪੈ ਗਏ ਬੜੇ ਖੂੰਖਾਰ ਕੁੱਤੇ ਪੈ ਗਏ ਮੈਂ ਸਾਈਕਲ ਹੋਰ ਤੇਜ਼ ਕਰ ਲਈ ਉਹ ਹੋਰ ਤੇਜ਼ ਦੌੜਨ ਲੱਗ ਪਏ ਮੈਂ ਹੋਰ ਤੇਜ਼ ਕਰ ਲਈ ਉਹ ਹੋਰ ਤੇਜ਼ ਦੌੜਨ ਲੱਗ ਪਏ ਮੇਰਾ ਸਾਈਕਲ ਕੁੱਤਿਆਂ ਵੱਲ ਐਨਾ ਧਿਆਰ ਧਿਆਨ ਪੈ ਗਿਆ ਸੀ ਕਿ ਮੈਂ ਸੜਕ ਵੱਲ ਧਿਆਨ ਹੀ ਨਹੀਂ ਗਿਆ ਕਿ ਗੱਡੀ ਮੈਨੂੰ ਟੱਕਰ ਮਾਰਨ ਲੱਗੀ ਸੀ ਮੈਂ ਬਹੁਤ ਹੀ ਬੜੀ ਮੁਸ਼ਕਲ ਨਾਲ ਬਚਿਆ ਮੈਂ ਡਰਦਾ ਘਬਰਾਉਂਦਾ ਘਬਰਾਉਂਦਾ ਕੁੱਤਿਆਂ ਕੋਲ ਬਚ ਕੇ ਅੱਗੇ ਗਿਆ ਤਾਂ ਮੇਰੇ ਮਗਰ ਦੋ ਚੋਰ ਪੈ ਗਏ ਸੀ ਮੈਂ ਉਹਨਾਂ ਕੋਲ ਡਰਦਾ ਡਰਦਾ ਫਿਰ ਮੈਂ ਅੱਗੇ ਭੱਜ ਕੇ ਗਿਆ ਉਹ ਮੇਰੇ ਮਗਰ ਅੱਧਾ ਘੰਟਾ ਲਗਾਤਾਰ ਪਏ ਰਹੇ ਮੈਂ ਕਾਫੀ ਤੇਜ਼ ਸਾਈਕਲ ਚਲਾਈ ਮੈਂ ਬ ਬੜੀ ਮੁਸ਼ਕਲ ਨਾਲ ਉਹਨਾਂ ਤੋਂ ਜਾਨ ਬਚਾਈ ਉੱਤੋਂ ਰੋਡ ਵੀ ਸਾਡੇ ਸਾ ਸਾਡੇ ਸ਼ਹਿਰ ਦੇ ਐਨੇ ਟੁੱਟੇ ਹੋਏ ਸੀ ਮੇਰੇ ਕੋਲ ਸਹੀ ਤਰੀਕੇ ਨਾਲ ਸਾਈਕਲ ਨਹੀਂ ਚਲਾਇਆ ਜਾ ਰਹੀ ਚਲਾਈ ਜਾ ਰਹੀ ਸੀ ਮੈਂ ਅੱਗੇ ਸਾਈਕਲ ਤੋਂ ਜੰਪ ਮਾਰਤੀ ਅਤੇ ਮੈਂ ਥੱਲੇ ਡਿੱਗ ਗਿਆ ਮੇਰੇ ਗੋਡਿਆਂ 'ਤੇ ਮੇਰੇ ਬਾਹਵਾਂ 'ਤੇ ਮੇਰੇ ਮੋਢਿਆਂ 'ਤੇ ਛ ਸਾਰੇ ਮੇਰੇ ਮ ਮਾਸ ਛਿੱਲਿਆ ਗਿਆ ਬਹੁਤ ਜ਼ਿਆਦਾ ਸੱਟ ਲੱਗ ਗਈ ਪਰ ਮੈਂ ਘਰ ਜਾ ਕੇ ਮੈਂ ਬੜੀ ਮੁਸ਼ਕਲ ਨਾਲ ਘਰ ਪਹੁੰਚਿਆ ਪਰ ਮੈਂ ਘਰ ਜਾ ਕੇ ਗੱਲ ਕਿਸੇ ਨੂੰ ਨਹੀਂ ਦੱਸੀ ਮੈਂ ਅੰਦਰੋਂ ਡਰਿਆ ਪਿਆ ਸੀ ਮੈਂ ਸਹਿਮਿਆ ਪਿਆ ਸੀ ਉਹ ਜ਼ਿੰਦਗੀ ਦਾ ਪਲ ਮੈਨੂੰ ਅੱਜ ਵੀ ਯਾਦ ਹੈ ਮੈਂ ਬੜੀ ਮੁਸ਼ਕਲ ਨਾਲ ਉਹਨੂੰ ਭੁਲਾਉਣ ਦੀ ਕੋਸ਼ਿਸ਼ ਵੀ ਕਰਦਾ ਹਾਂ ਬਟ ਮੈਂ ਭੁਲਾ ਨਹੀਂ ਪਾਉਂਦਾ ਬਟ ਓ ਓ ਉਹਨਾਂ ਮੈਨੂੰ ਹਿੰਮਤ ਵੀ ਮਿਲਦੀ ਹੈ ਕਿ ਅਸੀਂ ਔਕੜਾਂ ਨਾਲ ਜ਼ਿੰਦਗੀ ਵਿੱਚ ਜਿਹੜੀਆਂ ਔਕੜਾਂ ਆਉਂਦੀਆਂ ਹਨ ਉਹਦੇ ਨਾਲ ਆਪਾਂ ਕਿੱਦਾਂ ਨਜਿੱਠਣਾ ਹੈ